ਜਿਵੇਂ ਕਿ ਮੈਂ ਇੱਕ ਬਚਪਨ ਤੋਂ ਹੀ ਦੌੜਨ ਦੀ ਪ੍ਰਤਿਯੋਗਤਾਵਾਂ ਵਿੱਚ ਭਾਗ ਲੈਂਦੀ ਹਾਂ ਅਤੇ ਮੈਨੂੰ ਬਹੁਤ ਸੱਟਾਂ ਸੁੱਟਾ ਲੱਗਦੀਆਂ ਨੇ ਕਦੇ ਮੇਰੇ ਹੱਥ ਪੈਰ 'ਤੇ ਲੱਗ ਜਾਂਦੀ ਹੈ ਇੱਕ ਵਾਰੀ ਤਾਂ ਮੇਰੇ ਸਿਰ 'ਤੇ ਵੀ ਲੱਗੀ ਸੀ ਕਿਉਂਕਿ ਮੈਂ ਦੌੜਦੇ ਦੌੜਦੇ ਸਿੱਧਾ ਡਿੱਗ ਗਈ ਅਤੇ ਉਹ ਸਿਰ 'ਤੇ ਮੇਰੇ ਵੱਜ ਗਈ ਸੀ ਅਤੇ ਇਹਨਾਂ ਨੂੰ ਸੰਭਾਲਣ ਵਾਸਤੇ ਵੀ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਹਮੇਸ਼ਾ ਹੀ ਅਤੇ ਇਹਨਾਂ ਨੂੰ ਠੀਕ ਵੀ ਹਮੇਸ਼ਾ ਇੱਕ ਪੱਟੀ ਲਾ ਕੇ ਹੀ ਹੋ ਜਾਂਦਾ ਸੀ ਜਦੋਂ ਮੇਰੀ ਸੱਟ ਮੇਰੇ ਹੱਥ 'ਤੇ ਲੱਗੀ ਸੀ ਉਦੋਂ ਥੋੜ੍ਹੀ ਗਹਿਰੀ ਸੱਟ ਸੀ ਜਿਸਦੇ ਕਰਕੇ ਮੈਨੂੰ ਹੋਸਪਿਟਲ ਵੀ ਜਾਣਾ ਪੈ ਗਿਆ ਵਿੱਚੋਂ ਆਪਦੀ ਡਰੈਸਿੰਗ ਵਗੈਰਾ ਕਰਵਾਉਣ ਵਾਸਤੇ ਉਹਨਾਂ ਨੇ ਇੱਕ ਲਿਕੁਡ ਜਿਹਾ ਲਾ ਕੇ ਪਹਿਲੇ ਉਹਨੂੰ ਸਾਫ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਖੂਨ ਵੀ ਵਗੀ ਜਾਂਦਾ ਸੀ ਖੂਨ ਨੂੰ ਉਹਨਾਂ ਨੇ ਕਾਟਨ ਲਾ ਕੇ ਇੱਕ ਵਾਰੀ ਬੰਦ ਕੀਤਾ ਉਸ ਤੋਂ ਬਾਅਦ ਉਹਦੇ ਉੱਤੇ ਪੱਟੀ ਲਾਤੀ ਜਿਹੜੀ ਪੱਟੀ ਮੈਨੂੰ ਹਰ ਦੋ ਦਿਨਾਂ ਜਾ ਕੇ ਵਿਖਾਉਣੀ ਪੈਂਦੀ ਸੀ ਇਹ ਕੀ ਜ਼ਿ ਜ਼ਖਮ ਜਿਆਦਾ ਗਹਿਰਾ ਤਾਂ ਨਹੀਂ ਪਰ ਹੌਲੀ ਹੌਲੀ ਕਰਦੇ ਮਹੀਨੇ ਹਫਤੇ ਠੀ ਉਹ ਠੀਕ ਹੋ ਗਿਆ